ਨੈਕਲੈੱਸ ਦੀ ਇੱਕ ਸਮੱਸਿਆ ਸੀ ਕਿ ਸਾਇਡਾਂ ਤੋਂ ਬਹੁਤ ਜ਼ਿਆਦਾ ਤਿੱਖਾ ਸੀ ਜਿਸ ਨਾਲ ਮੇਰੇ ਕੱਪੜਿਆਂ ਵਿੱਚ ਫਸ ਜਾਂਦਾ ਸੀਗਾ ਅਤੇ ਉਹਦੇ ਨਗ ਵੀ ਬਹੁਤ ਜ਼ਿਆਦਾ ਨਿਕਲਣੇ ਸ਼ੁਰੂ ਹੋ ਚੁੱਕੇ ਸੀ